ਟੈਕਨੋਲਜੀ ਨੇ ਬੈਂਕਿੰਗ ਨੂੰ ਬਹੁਤ ਅਸਾਨ ਬਣਾ ਦਿੱਤਾ ਹੈ ਟੈਕਨੋਲੋਜੀ ਦੁਆਰਾ ਗਾਹਕ ਬੈਂਕ ਦੁਆਰਾ ਮੁੱਹਈਆ ਕਰਵਾਈਆਂ ਗਈਆਂ ਕੋਈ ਵੀ ਸੇਵਾਵਾਂ ਦੀ ਵਰਤੋਂ ਕਰ ਸਕਦਾ ਹੈ ਸ਼ਰਤਾਂ ਅਤੇ ਵਿਸ਼ੇਸ਼ਤਾਵਾਂ ਦੇ ਇਲਾਵਾ ਜਿਵੇਂ ਨਿਯਮਾਂ ਅਤੇ ਸ਼ਰਤ ਵਿੱਚ ਬੈਂਕ ਇੰਟਰਨੈੱਟ ਦੁਆਰਾ ਦਿੱਤੀਆਂ ਜਾਂਦੀਆਂ ਹਨ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਇੰਟਰਨੈੱਟ ਬੈਂਕਿੰਗ ਆਉਂਦੀ ਹੈ ਇੰਟਰਨੈੱਟ ਬੈਂਕਿੰਗ ਦੇ ਵਿੱਚ ਬੈਂਕਾਂ ਵੱਲੋਂ ਜਿਵੇਂ ਖ਼ਾਤੇ ਦੀ ਜਾਣਕਾਰੀ ਹੋ ਰਹੀ ਸੇਵਾ ਤੱਕ ਪਹੁੰਚਾ ਪਹੁੰਚ ਪ੍ਰਦਾਨ ਕਰਦਾ ਹੈ ਇੰਟਰਨੈੱਟ ਬੈਂਕਿੰਗ ਰਾਹੀਂ ਤੁਸੀਂ ਇਲੈਕਟ੍ਰੋਨਿਕ ਬੈਂਕਿੰਗ ਈ ਬੈਂਕਿੰਗ ਇੰਟਰਨੈੱਟ ਬੈਂਕਿੰਗ ਸੇਵਾਵਾਂ ਨੂੰ ਦੀ ਸਹੂਲਤ ਲੈ ਸਕਦੇ ਹੋ ਕਿਸੇ ਵੀ ਵਿਅਕਤੀ ਨੂੰ ਦਰਸਾਉਂਦਾ ਹੈ ਜਿਵੇਂ ਬੈਂਕ ਨਾਲ਼ ਖਾਤਾ ਅਤੇ ਜਿਸ ਨੂੰ ਇੰਟਰਨੈੱਟ ਬੈਂਕਿੰਗ ਸਹੂਲਤ ਜਾਂ ਕਿਸੇ ਵੀ ਹੋਰ ਸੇਵਾ ਦਾ ਲਾਭ ਪ੍ਰਾਪਤ ਹੋ ਸਕਦਾ ਹੈ ਇਸ ਦੇ ਨਾਲ਼ ਜਿਵੇਂ ਕਿ ਮੁਖੀ ਦਖਲਅੰਦਾਜ਼ੀ ਘੱਟ ਗਈ ਹੈ ਇਸ ਨੂੰ ਘੱਟ ਗਈ ਹੈ ਇਸ ਨਾਲ਼ ਵੀ ਬਹੁਤ ਉਲਝੇਵੇ ਪੈਂਦੇ ਹਨ ਜੋ ਲੋਕ ਅਨਪੜ੍ਹ ਹਨ ਉਨ੍ਹਾਂ ਨੂੰ ਟੈਕਨੋਲਜੀ ਬਾਰੇ ਨਹੀਂ ਪਤਾ ਅਤੇ ਉਹ ਆਪਣਾ ਨੁਕਸਾਨ ਕਰਵਾ ਬੈਠਦੇ ਹਨ ਅਤੇ ਜਿਵੇਂ ਅੱਜ ਕੱਲ੍ਹ ਟੈਕਨੋਲਜੀ ਦੇ ਰਾਹੀਂ ਫਰੋਡ ਕੀਤੇ ਜਾਂਦੇ ਹਨ ਜਿਸ ਦੇ ਨਾਲ਼ ਬੈਂਕਾਂ ਦੇ ਵਿੱਚੋਂ ਬੰਦਿਆਂ ਤੋਂ ਓਟ ਓ ਟੀ ਪੀ ਲੈ ਕੇ ਉਨ੍ਹਾਂ ਦੇ ਖ਼ਾਤੇ ਖ਼ਾਲੀ ਕੀਤੇ ਜਾਂਦੇ ਹਨ ਇਹ ਮਨੁੱਖੀ ਦਖਲਅੰਦਾਜ਼ੀ ਘੱਟ ਹੋਣ ਦੇ ਕਾਰਨ ਹੀ ਉਲਝੇਵੇ ਪੈ ਰਹੇ ਹਨ